ਪਿੰਡ ਵਿੱਚ ਪਰਿਵਾਰਾਂ ਦੇ ਝਗੜੇ ਅਕਸਰ ਚੱਲਦੇ ਰਹਿੰਦੇ ਹਨ ਅਤੇ ਇਹਨਾਂ ਝਗੜਿਆਂ ਨੂੰ ਹੱਲ ਕਰਨ ਲਈ ਜਾਂ ਤਾਂ ਇਹ ਹੱਲ ਝਗੜਿਆਂ ਦਾ ਘਰ ਦੇ ਵੱਡੇ ਕਰਦੇ ਹਨ ਜਾਂ ਤਾਂ ਪੰਚਾਇਤ ਕਰਦੀ ਹੈ ਬਹੁਤ ਸਾਰੇ ਘਰ ਵਿੱਚ ਇਹ ਪਰਿਵਾਰਾਂ ਵਿੱਚ ਝਗੜਿਆਂ ਦਾ ਹੱਲ ਪੰਚਾਇਤ ਹੀ ਕਰਦੀ ਹੈ ਜਿਵੇਂ ਕਿ ਸਾਡੇ ਗੁਆਂਢ ਵਿੱਚ ਇੱਕ ਦਿਨ ਕਾਫੀ ਝਗੜਿਆ ਹੋਇਆ ਤਾਂ ਇਸ ਵਿੱਚ ਦੋ ਭਰਾ ਆਪਸ ਵਿੱਚ ਜ਼ਮੀਨ ਨੂੰ ਲੈ ਕੇ ਝਗੜਾ ਕਰ ਰਹੇ ਸੀਗੇ ਅਤੇ ਇਹ ਕਾਫੀ ਵੱਧ ਗਿਆ ਕਿਉਂਕਿ ਆਂਢ ਗੁਆਂਢ ਇਹਨਾਂ ਦਾ ਕੰਨ ਭਰਦੇ ਰਹੇ ਅਤੇ ਇਹ ਝਗੜਾ ਹੈ ਤਾਂ ਛੋਟਾ ਸੀ ਪਰ ਕਾਫੀ ਵੱਧ ਗਿਆ ਇਹ ਝਗੜਾ ਅਤੇ ਇਸਨੂੰ ਹੱਲ ਕਰਨ ਲਈ ਪੰਚਾਇਤ ਇਹਦਾ ਹੱਲ ਕੀਤਾ ਪੰਚਾਇਤ ਨੇ ਅਤੇ ਪੰਚਾਇਤ ਜਦ ਹੱਲ ਕਰ ਗਈ ਹੁਣ ਤਾਂ ਉਹ ਦੋਨੋਂ ਆਪਸ ਵਿੱਚ ਕਾਫੀ ਠੀਕ ਹੈ ਅਤੇ ਉਹਨਾਂ ਦੀ ਜ਼ਮੀਨ ਦਾ ਹੱਲ ਵੀ ਹੋ ਗਿਆ